ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਮੇਰੇ ਖੇਤਰ ਵਿੱਚ ਪੰਜਾਬ ਦੇ ਖੇਤਰ ਦੀਆਂ ਰਵਾਇਤੀ ਬੁਣਾਈ ਅਤੇ ਸਿਲਾਈ ਤਕਨੀਕਾਂ ਬਹੁਤ ਪ੍ਰਸਿੱਧ ਹਨ ਇਹਨਾਂ ਵਿੱਚੋਂ ਕੁਝ ਪ੍ਰਮੁੱਖ ਤਕਨੀਕਾਂ ਹਨ ਜਿਵੇਂ ਕਿ ਫੁਲਕਾਰੀ ਫੁਲਕਾਰੀ ਵਿੱਚ ਕੀ ਹੁੰਦਾ ਹੈ ਕਿ ਫੁਲਕਾਰੀ ਪੰਜਾਬ ਦੀ ਇੱਕ ਪ੍ਰਸਿੱਧ ਕਢਾਈ ਕਲਾ ਹੈ ਜੋ ਕਿ ਕੁਝ ਸਦੀ ਪੁਰਾਣੀ ਹੈ ਇਸ ਵਿੱਚ ਕੀ ਹੁੰਦਾ ਹੈ ਕਿ ਇਸ ਵਿੱਚ ਇੱਕ ਚਿੱਟੇ ਕੱਪੜੇ 'ਤੇ ਰੰਗ ਬਿਰੰਗੇ ਧਾਗਿਆਂ ਨਾਲ ਨਾ ਕਢਾਈ ਕੀਤੀ ਜਾਂਦੀ ਹੈ ਅਤੇ ਇਹ ਕਢਾਈ ਆਮ ਤੌਰ 'ਤੇ ਦੁਪੱਟਿਆਂ ਜਾਂ ਫਿਰ ਸ਼ਾਲਾਂ ਦੀ ਕੀਤੀ ਜਾਂਦੀ ਹੈ ਇਹ ਸ ਦੇਖਣ ਵਿੱਚ ਬਹੁਤ ਸੁੰਦਰ ਹੁੰਦੀ ਹੈ ਦੂਜੀ ਗੱਲ ਕਰੀਏ ਤਾਂ ਇਸ ਵਿੱਚ ਆਉਂਦਾ ਹੈ ਪੱਟ ਪੱਟ ਵਿੱਚ ਕੀ ਹੁੰਦਾ ਪੱਟ ਵਿੱਚ ਨਾ ਇੱਕ ਰੁੱਖਾ ਮੋਟਾ ਕੱਪੜਾ ਹੁੰਦਾ ਹੈ ਜੋ ਕਿ ਖਾਸ ਤੌਰ 'ਤੇ ਸਾਦੀ ਬੁਣਾਈ ਨਾਲ ਬਣਿਆ ਹੁੰਦਾ ਹੈ ਇਸ ਵਿੱਚ ਕੀ ਹੁੰਦਾ ਹੈ ਇਹ ਆਮ ਤੌਰ 'ਤੇ ਚਾਦਰਾਂ 'ਤੇ ਹੁੰਦਾ ਹੈ ਜਾਂ ਫਿਰ ਘਰ ਦੇ ਸਜਾਵਟ ਵਾਸਤੇ ਸਮਾਨ ਬਣਾਉਣ ਲਈ ਵਰਤਿਆ ਜਾਂਦਾ ਤੀਜਾ ਹੁੰਦਾ ਹੈ ਕਿ ਸਾਡਾ ਬਾਗ ਬਾਗ ਵਿੱਚ ਕੀ ਹੁੰਦਾ ਹੈ ਬਾਗ ਇੱਕ ਕਿਸਮ ਦੀ ਫੁਲਕਾਰੀ ਹੀ ਹੈ ਇਹ ਵੀ ਫੁਲਕਾਰੀ ਵਾਂਗ ਹੀ ਹੁੰਦਾ ਸੇਮ ਟੂ ਸੇਮ ਇਸ ਵਿੱਚ ਕੀ ਹੁੰਦਾ ਪੂਰਾ ਕੱਪੜਾ ਜਿਹੜਾ ਹੁੰਦਾ ਨਾ ਕਢਾਈ ਨਾਲ ਕਵਰ ਕੀਤਾ ਜਾਂਦਾ ਅਤੇ ਪੂਰਾ ਕੱਪੜਾ ਕਢਾਈ ਨਾਲ ਕਵਰ ਹੋ ਜਾਂਦਾ ਹੈ ਅਤੇ ਇਹ ਬਹੁਤ ਹੀ ਖੂਬਸੂਰਤ ਹੁੰਦਾ ਹੈ ਖੂਬਸੂਰਤ ਵੀ ਹੁੰਦਾ ਹੈ ਅਤੇ ਇਹ ਵਿਆਹ ਵਰਗੇ ਖਾਸ ਮੌਕਿਆਂ 'ਤੇ ਵਰਤਿਆ ਜਾਂਦਾ ਹੈ ਅਕਸਰ ਪੰਜਾਬ ਵਿੱਚ ਅਤੇ ਰਵਾਇਤੀ ਕੱਪੜੇ ਬਣਾਉਣ ਜਾਂ ਤਜਰਬਾ ਜਦੋਂ ਮੈਂ ਰਵਾਇਤੀ ਕੱਪੜੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਨਾ ਮੈਂ ਸਭ ਤੋਂ ਪਹਿਲਾਂ ਫੁਲਕਾਰੀ ਦੀ ਕਢਾਈ ਸਿੱਖੀ ਸੀ ਇਹ ਇੱਕ ਬਹੁਤ ਹੀ ਧੀਰਜ ਅਤੇ ਮਿਹਨਤ ਵਾਲਾ ਕੰਮ ਹੁੰਦਾ ਵੈਸੇ ਪਰ ਨਤੀਜਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੇਰੇ ਜਦੋਂ ਪਹਿਲੀ ਵਾਰੀ ਕੀਤਾ ਸੀ ਤਾਂ ਮੈਂ ਇੱਕ ਛੋਟਾ ਦੁਪੱਟਾ ਬਣਾਇਆ ਜੋ ਕਿ ਪੂਰੀ ਤਰ੍ਹਾਂ ਕਢਾਈ ਨਾਲ ਸਜਾਇਆ ਹੋਇਆ ਸੀ ਧੰਨਵਾਦ